ਪੰਜਾਬ ਵਿੱਚ ਆਕਰਸ਼ਣ ਦਾ ਕੇਂਦਰ ਵੇਖਣ ਵਾਸਤੇ ਆਪਣੇ ਗੁਰਦੁਆਰੇ ਗੋਲਡਨ ਟੈਂਪਲ ਗੋਇੰਦਵਾਲ ਸਾਹਿਬ ਕਾਫ਼ੀ ਮਸ਼ਹੂਰ ਹਨ ਜਿਹਨਾਂ ਨੂੰ ਆਪਾਂ ਮੱਥਾ ਟੇਕ ਕੇ ਸਤਮਸਤਕ ਹੋ ਕੇ ਵੇਖਣ ਜਾਂਦੇ ਹਾਂ ਦੂਸਰਾ ਆਪਾਂ ਕਹਿਣਾ ਚਾਹਵਾਂਗੇ ਕਿ ਵਿਰਾਸਤ ਖਾਲਸਾ ਜਲਿਆਂ ਵਾਲਾ ਬਾਗ ਵਾਗਾ ਬੋਡਰ ਆਦਿ ਬਹੁਤ ਹੀ ਆਕਰਸ਼ਣ ਦੇ ਕੇਂਦਰ ਹਨ ਜਿਹਨਾਂ ਨੂੰ ਆਪਾਂ ਘੁੰਮਣ ਫਿਰਣ ਵਾਸਤੇ ਵੇਖਣ ਜਾ ਸਕਦੇ ਹਾਂ